ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਸ਼ ਮਹਾਜਨ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਵੈਸੇ ਤਾਂ ਮੈਨੂੰ ਸ਼ੇਅਰ ਮਾਰਕੀਟ ਬਾਰੇ ਜ਼ਿਆਦਾ ਕੁੱਛ ਨਹੀਂ ਪਤਾ ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਸ਼ੇਅਰ ਮਾਰਕੀਟ ਦੀ ਸਹੀ ਸਹੀ ਜਾਣਕਾਰੀ ਦੇ ਸਕਾਂ ਸ਼ੇਅਰ ਮਾਰਕੀਟ ਇੱਕ ਛੋਟੇ ਟੈਮ ਦਾ ਜੂਆ ਹੈ ਇਹ ਕਦੇ ਵੀ ਵੱਧ ਸਕਦਾ ਹੈ ਅਤੇ ਕਦੇ ਵੀ ਘੱਟ ਸਕਦਾ ਹੈ ਅੱਜ ਕੱਲ੍ਹ ਲੋਕ ਸ਼ੇਅਰ ਮਾਰਕੀਟ ਨੂੰ ਆਪਣੇ ਫ਼ੋਨ ਲੈਪਟੋਪ ਕਿਤੇ ਵੀ ਖੋਲ੍ਹ ਸਕਦੇ ਨੇ ਇਹ ਕਾਫੀ ਵੈਬਸਾਈਟਾਂ 'ਤੇ ਫੈਲਿਆ ਹੋਇਆ ਹੈ ਜਿਵੇਂ ਕਿ ਕੁਛ ਪੋਪੂਲਰ ਵੈਬਸਾਈਟ ਜਿਵੇਂ ਕਿ ਅਪਸਟੋਕਸ ਹੋਗੀ ਜਾਂ ਫਿਰ ਸ਼ੇਅਰ ਐੱਪ ਹੋਗੀ ਹੋਰ ਵੀ ਬਹੁਤ ਸਾਰੀ ਵੈੱਬਸਾਈਟਾਂ ਨੇ ਅਤੇ ਸ਼ੇਅਰ ਮਾਰਕੀਟ ਇੱਕ ਇੱਦਾਂ ਦਾ ਪਲੈਟਫੋਮ ਹੈ ਜਿੱਥੇ ਲੋਕ ਕੰਪਨੀਜ਼ ਦੇ ਸ਼ੇਅਰ ਖਰੀਦਦੇ ਅਤੇ ਵੇਚਦੇ ਨੇ ਸ਼ੇਅਰ ਮਾਰਕੀਟ ਵਿੱਚ ਟ੍ਰਾਂਜੈਕਸ਼ਨ ਜਦ ਕੰਪਲੀਟ ਹੋ ਜਾਂਦੀ ਹੈ ਜਿਹੜਾ ਦਿਨ ਦੀ ਅਤੇ ਬੰਦੇ ਨੂੰ ਆਪਣੇ ਪ੍ਰੋਫਿਟ ਅਤੇ ਲੋਸ ਦਾ ਪਤਾ ਲੱਗਦਾ ਅਤੇ ਉਹਦਾ ਪ੍ਰੋਫਿਟ ਅਤੇ ਲੋਸ ਡਿਪੇਂਡ ਕਰਦਾ ਕਿ ਜਿਸ ਜਿਹੜਾ ਸ਼ੇਅਰ ਉਹਨੇ ਲਿਆ ਉਹਦਾ ਸਵੇਰੇ ਪ੍ਰਾਈਸ ਕਿੰਨਾ ਸੀ ਅਤੇ ਲਾਸਟ 'ਚ ਵੇਚਣ ਵੇਲੇ ਪ੍ਰਾਈਸ ਕਿੰਨਾ ਸੀ ਉਸ ਹਿਸਾਬ ਨਾਲ ਪ੍ਰੋਫਿਟ ਡਿਫੈਂਡ ਕਰਦਾ ਅਤੇ ਇੱਕ ਅਗਰ ਸ਼ੇਅਰ ਡਿੱਗ ਜਾਏ ਉਹਦਾ ਡਿੱਗਣ ਦਾ ਰੀਜ਼ਨ ਇਹ ਹੁੰਦਾ ਹੈ ਕਿ ਜਿਹੜੇ ਉਹ ਸ਼ੇਅਰ ਦੇ ਵੇਚਣ ਵਾਲੇ ਬਹੁਤ ਸਾਰੇ ਲੋਕ ਹੁੰਦੇ ਨੇ ਪਰ ਉਹਨੂੰ ਖਰੀਦਣ ਵਾਲਾ ਕੋਈ ਨਹੀਂ ਹੁੰਦਾ ਮਤਲਬ ਕਿ ਉਹਦੀ ਡਿਮਾਂਡ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਔਰ ਈ ਸਪਲਾਈ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹਦੀ ਡਿਮਾਂਡ ਕੋਈ ਨਹੀਂ ਕਰਦਾ ਓਹੀ ਦੂਜੇ ਪਾਸੇ ਜਿਹੜੇ ਸੇ ਸ਼ੇਅਰ ਬਹੁਤ ਜ਼ਿਆਦਾ ਉੱਪਰ ਚੜ੍ਹਦੇ ਹੁੰਦੇ ਨੇ ਉਹ ਇਸ ਵਾਸਤੇ ਚੜ੍ਹਦੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਡਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹਨਾਂ ਦਾ ਸ ਉਹ ਸਟੋਕ 'ਚ ਨਹੀਂ ਹੁੰਦੇ ਉਹਨਾਂ ਕੋਲ ਵੇਚਣ ਵਾਸਤੇ ਇਸ ਲਈ ਉਹ ਸ਼ੇਅਰ ਉੱਪਰ ਬਹੁਤ ਹੀ ਮਹਿੰਗੇ ਹੁੰਦੇ ਨੇ ਅਤੇ ਕੁ ਮੈਂ ਕੁਛ ਹੋਰ ਵੀ ਗੱਲਾਂ ਦੱਸਣਾ ਚਾਹਾਂਗਾ ਸ਼ੇਅਰ ਮਾਰਕੀਟ ਬਾਰੇ ਜਿਹੜੀ ਇੱਕ ਆਮ ਬੰਦੇ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਜਿਵੇਂ ਕਿ ਬੀ ਐੱਸ ਈ ਸ 'ਚ ਇਨਵੈਸਟ ਕਰਨਾ ਹਮੇਸ਼ਾ ਰਿਸਕ ਵਾਲਾ ਕੰਮ ਹੁੰਦਾ ਹੈ ਅਤੇ ਕਾਫ਼ੀ ਵਾਰੀ ਜਦ ਬੰਦਾ ਸ਼ੇਅਰ ਖਰੀਦਦਾ ਹੈ ਅਤੇ ਉਹਨੂੰ ਇੱਕ ਬ੍ਰੋਕੇਜ ਅਮਾਊਂਟ ਪਹਿਲਾਂ ਹੀ ਦੇਣੀ ਪੈਂਦੀ ਹੈ ਅਤੇ ਜਦ ਉਹ ਲਾਸਟ 'ਚ ਵੇਚਦਾ ਜੇ ਉਹਦੇ ਕੋਲ ਘੱਟ ਪ੍ਰੋਫਿਟ ਹੋਏਗਾ ਅਤੇ ਉਹ ਪ੍ਰੋਫਿਟ ਬ੍ਰੋਕੇਜ ਅਮਾਊਂਟ 'ਚ ਹੀ ਚਲਾ ਜਾਂਦਾ ਹੈ ਅਤੇ ਬੰਦੇ ਨੂੰ ਕੋਈ ਪ੍ਰੋਫਿਟ ਨਹੀਂ ਹੁੰਦਾ ਉਹ ਸਾਰਾ ਲੋਸ 'ਚ ਚਲਾ ਜਾਂਦਾ ਹੈ ਅਤੇ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ ਕਿ ਤੁਸੀਂ ਮੈਨੂੰ ਸੁਣਿਆ ਅਤੇ ਮੇਰੀ ਜਾਣਕਾਰੀ ਜੇ ਤੁਹਾਨੂੰ ਠੀਕ ਲੱਗੀ ਤਾਂ ਥੈਂਕ ਊ